ਦੋ ਇੱਕ ਮਾਰਚ ਦੋ ਜੀਰੋ ਜੀਰੋ ਤਿੰਨ ਪੰਜ ਜਨਵਰੀ ਦੋ ਜੀਰੋ ਜੀਰੋ ਤਿੰਨ ਇੱਕ ਦਸੰਬਰ ਦੋ ਜੀਰੋ ਜੀਰੋ ਇੱਕ ਇੱਕ ਜਨਵਰੀ ਦੋ ਜੀਰੋ ਜੀਰੋ ਛੇ ਛੇ ਜੂਨ ਇੱਕ ਨੌਂ ਪੰਜ ਛੇ